ਸਤਿ ਸ਼੍ਰੀ ਅਕਾਲ ਜੀ ਫਲਿੱਪਕਾਟ ਮੈਂ ਥੋੜ੍ਹੇ ਦਿਨ ਪਹਿਲਾਂ ਤੁਹਾਡੀ ਸਾਈਟ ਤੋਂ ਮੋਟਰੋਲਾ ਦਾ ਮੋਬਾਇਲ ਲਿੱਤਾ ਸੀਗਾ ਮੇਰਾ ਜਿਹੜਾ ਮੋਬਾਇਲ ਹੈਗਾ ਉਹਦਾ ਮਾਡਲ ਨੰਬਰ ਜੈੱਡ ਵਨ ਜ਼ੀਰੋ ਹੈ ਇਹ ਮੋਬਾਇਲ ਬੜਾ ਚੰਗਾ ਲੱਗਿਆ ਮੈਨੂੰ ਕਿਉਂਕਿ ਜਿਸ ਪਰਾਇਜ਼ ਪੁਆਇੰਟ 'ਤੇ ਇਹ ਮੋਬਾਇਲ ਹੈਗਾ ਇਹਦੀ ਕੀਮਤ ਸੀਗੀ ਪੰਦਰਾਂ ਹਜ਼ਾਰ ਰੁਪਏ ਅਤੇ ਬੈਂਕ ਆਫਰ ਲਾ ਕੇ ਇਹ ਮੇਨੂੰ ਤੇਰ੍ਹਾਂ ਹਜ਼ਾਰ ਪੰਜ ਸੌ ਰੁਪਏ 'ਤੇ ਮਿਲ ਗਿਆ ਸੀਗਾ ਇਸ ਕੀਮਤ 'ਤੇ ਮੈਂ ਦੇਖਿਆ ਕਿ ਇਹਦੀ ਜਿਹੜੀ ਸ ਬਿਲਟ ਕਵਾਲਟੀ ਹੈਗੀ ਹੈ ਉਹ ਬੜੀ ਵਧੀਆ ਹੈਗੀ ਹੈ ਇਹਦਾ ਸਕਰੀਨ ਦਾ ਸਾਈਜ਼ ਸਿਕਸ ਪੁਆਇੰਟ ਫਾਈਵ ਹੈਗਾ ਉਹ ਬਹੁਤ ਚੰਗਾ ਹੈਗਾ ਅਤੇ ਇਹਦੀ ਜਿਹੜੀ ਸਪੀਕਰ ਹੈਗੇ ਉਹ ਵੀ ਐਟਮੋਸ ਡੌਲਬੀ ਦੇ ਹੈਗੇ ਜਿਹੜੀ ਬੜੀ ਵਧੀਆ ਆਵਾਜ਼ ਮਿਲਦੀ ਆ